ਜਿੱਦਾਂ ਕਿ ਤੁਸੀਂ ਸਾਰੇ ਜਾਣੇ ਜਾਣਦੇ ਹੀ ਹੋ ਜਦੋਂ ਲੋਕਡਾਊਨ ਲੱਗਾ ਸੀਗਾ ਅਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਸੀਗੇ ਅਤੇ ਜੇ ਕਦੀ ਕਿਤੇ ਸਾਡਾ ਫਾਸਟ ਫੂਡ ਖਾਣ ਦਾ ਮਨ ਵੀ ਕਰਦਾ ਸੀਗਾ ਤਾਂ ਵੀ ਅਸੀਂ ਬਾਹਰੋਂ ਨਹੀਂ ਖਾ ਸਕਦੇ ਸੀਗੇ ਕਿਉਂਕਿ ਦੁਕਾਨਾਂ ਲੋਕਡਾਊਨ ਦੇ ਕਾਰਨ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਸੀਗੀਆਂ ਅਤੇ ਇਸ ਦੇ ਲਈ ਫਿਰ ਸਾਨੂੰ ਘਰੇ ਹੀ ਉਹ ਚੀਜ਼ਾਂ ਸਾਰੀਆਂ ਬਣਾਉਣੀਆਂ ਪੈਂਦੀਆਂ ਸੀਗੀਆਂ ਅਤੇ ਲੋਕਡਾਊਨ ਵਿੱਚ ਮੈਂ ਘਰ ਕਾਫੀ ਕੁਛ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਪੀਜ਼ਾ ਡੋਸਾ ਬਰਗਰ ਨਊਡਲ ਸਪਰਿੰਗ ਰੋਲ ਜਿਵੇਂ ਕਿ ਅਸੀਂ ਕਹਿ ਲਈਏ ਕਿ ਡੋਸਾ ਉਹਦੇ ਲਈ ਸਾਨੂੰ ਇੰਨੇ ਖਾਸ ਜ਼ਿਆਦਾ ਸਾਮਾਨ ਦੀ ਜ਼ਰੂਰਤ ਨਹੀਂ ਪੈਂਦੀ ਵੱਧ ਤੋਂ ਵੱਧ ਸਾਨੂੰ ਚੌਲਾਂ ਦੀ ਜ਼ਰੂਰਤ ਪੈਂਦੀ ਹੈ ਦਾਲਾਂ ਦੀ ਜ਼ਰੂਰਤ ਪੈਂਦੀ ਹੈ ਜੋ ਕਿ ਸਾਡੇ ਘਰ ਵਿੱਚ ਪਹਿਲਾਂ ਤੋਂ ਹੀ ਪਈਆਂ ਹੁੰਦੀਆਂ ਹਨ ਅਗਰ ਅਸੀਂ ਪੀਜ਼ਾ ਬਣਾਉਣ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵੀ ਸਾਨੂੰ ਬਾਹਰੋਂ ਇੰਨੀਆਂ ਸਾਰੀਆਂ ਚੀਜ਼ਾਂ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਓਲਮੋਸਟ ਸਾਡੇ ਘਰ ਵਿੱਚ ਹੀ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਹਨ ਉਹਦੇ ਲਈ ਜ਼ਿਆਦਾਤਰ ਸਬਜ਼ੀਆਂ ਦੀ ਜ਼ਰੂਰਤ ਪੈਂਦੀ ਆ ਉਹ ਸਬਜ਼ੀਆਂ ਜਿਹੜੀਆਂ ਅਸੀਂ ਡੇਲੀ ਆਪਣੇ ਖਾਂਦੇ ਹੁੰਦੇ ਹਾਂ ਉਹ ਸਾਰੀਆਂ ਚੀਜ਼ਾਂ ਦੀ ਹੀ ਜ਼ਰੂਰਤ ਪੈਂਦੀ ਆ ਹੋਰ ਵੀ ਕਈ ਜ਼ਿਆਦਾ ਫਾਸਟ ਫੂਡਸ ਨੇ ਜਿਹਨਾਂ ਨੂੰ ਬਣਾਉਣ ਦੇ ਲਈ ਜ਼ਿਆਦਾ ਸਾਮਾਨ ਦੀ ਜ਼ਰੂਰਤ ਨਹੀਂ ਪੈਂਦੀ ਇਸ ਦੇ ਲਈ ਲੋਕਡਾਊਨ ਵਿੱਚ ਇੱਦਾਂ ਦੀਆਂ ਕਾਫੀ ਚੀਜ਼ਾਂ ਸੀਗੀਆਂ ਜਿੰਨਾ ਜਿਹੜਾ ਕਿ ਸਾਮਾਨ ਸਾਡੇ ਘਰ ਵਿੱਚ ਹੁੰਦਾ ਸੀਗਾ ਅਸੀਂ ਉਹੀ ਸਭ ਚੀਜ਼ਾਂ ਬਣਾਉਣ ਦੀ ਕਾਫੀ ਜ਼ਿਆਦਾ ਕੋਸ਼ਿਸ਼ ਕੀਤੀ ਸੀਗੀ ਇਹ ਸਾਰੀਆਂ ਚੀਜ਼ਾਂ ਮੈਂ ਯੂਟੀਊਬ ਤੋਂ ਸਿੱਖੀਆਂ ਸੀਗੀਆਂ ਅਤੇ ਫਿਰ ਮੈਂ ਘਰੇ ਬਣਾਈਆਂ ਸੀ ਅਤੇ ਕਾਫੀ ਜ਼ਿਆਦਾ ਵਧੀਆ ਵੀ ਬਣੀਆਂ ਸੀ ਅਤੇ ਸਵਾਦ ਵੀ ਉਹਨਾਂ ਦਾ ਕਾਫੀ ਜ਼ਿਆਦਾ ਵਧੀਆ ਸੀ ਅਗਰ ਦੇਖਿਆ ਜਾਵੇ ਤਾਂ ਘਰ ਵਿੱਚ ਜਿਹੜੀਆਂ ਅਸੀਂ ਚੀਜ਼ਾਂ ਬਣਾਉਂਦੇ ਹਾਂ ਇਹਨਾਂ ਦਾ ਸਵਾਦ ਅਤੇ ਬਾਜ਼ਾਰ ਦੀਆਂ ਚੀਜ਼ਾਂ ਦਾ ਸਵਾਦ ਕਾਫੀ ਜ਼ਿਆਦਾ ਵਧੀਆ ਹੁੰਦਾ ਕਿਉਂਕਿ ਬਾਜ਼ਾਰ ਵਿੱਚ ਇਹ ਸਾਰੀਆਂ ਚੀਜ਼ਾਂ ਇੰਨੇ ਸਾਫ ਸਫਾਈ ਦੇ ਨਾਲ ਨਹੀਂ ਬਣਾਈਆਂ ਜਾਂਦੀਆਂ ਜਿੰਨੀਆਂ ਅਸੀਂ ਘਰ ਵਿੱਚ ਇਹਨਾਂ ਨੂੰ ਸਾਫ ਸਫਾਈ ਦੇ ਨਾਲ ਬਣਾ ਲੈਂਦੇ ਆ